ਮੁਰਗੀਆਂ ਦਾ ਪਲੋਟਰੀ ਫਾਰਮ ਇਹ ਕਿਸਾਨ ਦਾ ਸਹਾਇਕ ਧੰਦਾ ਹੈ ਉਹ ਜਦੋਂ ਕੋਈ ਪਲੋਟਰੀ ਫਾਰਮ ਚਲਾਉਂਦਾ ਹੈ ਤਾਂ ਉਸ ਦੇ ਵਿੱਚ ਜਾਨਵਰ ਨਿੱਕੇ ਬੱਚੇ ਜਿਹੜੇ ਹੈਗੇ ਚੂਚੇ ਹੁੰਦੇ ਆ ਜਾਂ ਜਵਾਨ ਚੂਚੇ ਹੁੰਦੇ ਆ ਉਹਨਾਂ ਨੂੰ ਲਿਆ ਕੇ ਛੱਡਦਾ ਉਹ ਕਿਸੇ ਵੀ ਯਾਨੀ ਕਿ ਕੰਪਨੀ ਤੋਂ ਲੈਂਦਾ ਅਤੇ ਜਾਂ ਕਿਸੇ ਵੀ ਯੂਨੀਵਰਸਿਟੀ ਤੋਂ ਲੈਂਦਾ ਹੈ ਨਾ ਉਹਨਾਂ ਨੂੰ ਮੰਗਵਾਉਂਦਾ ਹੈ ਦੋ ਸੌ ਦੇ ਹਿਸਾਬ ਨਾਲ ਜਿਵੇਂ ਬੱਚੇ ਉਹਨਾਂ ਨੇ ਮੰਗਵਾ ਲਏ ਤਾਂ ਉਹਨਾਂ ਬੱਚਿਆਂ ਨੂੰ ਦੇਖਭਾਲ ਦੇ ਲਈ ਉਹ ਸਾਰਿਆਂ ਤੋਂ ਪਹਿਲਾਂ ਤਾਂ ਉਹਨਾਂ ਦੀ ਆਸ ਪਾਸ ਦੀ ਜਿਹੜੀ ਜਿਹੜਾ ਜਗ੍ਹਾ ਜਿੱਥੇ ਰੱਖਦਾ ਪਲੋਟਰੀ ਫਾਰਮ ਦੀ ਸਫਾਈ ਦਾ ਵੀ ਇਹਨਾਂ ਨੂੰ ਕੋਈ ਬਿਮਾਰੀ ਨਾ ਲੱਗੇ ਡੇਲੀ ਉਸ ਨੂੰ ਜਗ੍ਹਾ ਨੂੰ ਸਾਫ਼ ਕਰਨਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਬਿੱਠਾਂ ਹੁੰਦੀਆਂ ਨੇ ਉਹਨਾਂ ਤੋਂ ਬਹੁਤ ਛੇਤੀ ਯਾਨੀ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੀ ਉਹਨਾਂ ਨੂੰ ਬਿਮਾਰੀ ਬਣਦੀ ਉਹਦੇ ਨਾਲ ਮਰਨ ਦਾ ਖ਼ਤਰਾ ਰਹਿੰਦਾ ਹੈ ਨਾ ਅਤੇ ਇਸ ਤੋਂ ਬਾਅਦ ਕਿ ਡੇਲੀ ਉਹਨਾਂ ਨੂੰ ਸਫਾਈ ਕਰ ਕੇ ਤਾਂ ਉਸ ਤੋਂ ਬਾਅਦ ਉੱਥੇ ਉਹਨਾਂ ਦੇ ਜਿਹੜਾ ਕਿ ਵੀ ਕਲੀ ਵਗੈਰਾ ਖਿਲਾਰੀ ਜਾਂਦੀ ਆ ਕਲੀ ਜਿਹੜੀ ਆਪਣੀ ਚੂਨਾ ਹੁੰਦਾ ਹੈਗਾ ਉਹਨੂੰ ਖਿਲਾਰਿਆ ਜਾਂਦਾ ਕਿਉਂਕਿ ਉਹਦੇ ਨਾਲ ਬਿਮਾਰੀ ਜਿਹੜੀ ਇਫੈਕਸ਼ਨ ਵਗੈਰਾ ਉਹ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਆ ਹਾਂ ਇਸ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਪਾਣੀ ਆ ਪੀਣ ਲਈ ਕਿਉਂਕਿ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਜਿਹੜਾ ਚੂਚਾ ਹੈਗਾ ਨਿੱਕਾ ਜਾਂ ਕੁੱਕੜ ਹੈ ਵੱਡਾ ਉਹ ਇਹ ਪਲੋਟਰੀ ਫਾਰਮ ਦੇ ਵਿੱਚ ਜਿੰਨੇ ਵੀ ਜਾਨਵਰ ਵੱਡੇ ਛੋਟੇ ਨੇ ਉਹ ਯਾਨੀ ਕਿ ਪਾਣੀ ਬਹੁਤ ਜ਼ਿਆਦਾ ਪੀਂਦੇ ਨੇ ਤਾਂ ਅ ਪਾਣੀ ਦੇ ਵਿੱਚ ਵੀ ਕੋਈ ਉਹਨਾਂ ਨੂੰ ਜਿਹੜੀ ਹੁਣ ਦਵਾਈ ਹੁੰਦੀ ਹੈਗੀ ਉਹ ਪਾਣੀ ਦੇ ਵਿੱਚ ਜਿੰਨੇ ਵਾਰੀ ਉਹਨਾਂ ਨੂੰ ਪਾਣੀ ਪਿਆਉਣਗੇ ਰੱਖਣਗੇ ਉਹਨਾਂ ਦੇ ਮੂਹਰੇ ਤਾਂ ਉਨੇ ਵਾਰੀ ਉਹ ਇੱਕ ਜਾਂ ਦੋ ਤਿੰਨ ਤਿੰਨ ਬੂੰਦਾਂ ਉਹਦੀਆਂ ਵਿੱਚ ਪਾਉਣਗੇ ਵੀ ਉਹਦੇ ਨਾਲ ਉਹਨਾਂ ਨੂੰ ਕੋਈ ਇੰਫੈਕਸ਼ਨ ਵਗੈਰਾ ਜਾਂ ਕੋਈ ਹੋਰ ਬਿਮਾਰੀ ਨਾ ਲੱਗੇ ਹਾਂ ਇਸ ਤੋਂ ਬਾਅਦ ਜਿਹੜੀ ਉਹਨਾਂ ਦੀ ਫੀਡ ਹੈ ਫੀਡ 'ਤੇ ਆ ਗਿਆ ਫੀਡ ਜਿਹੜੀ ਪ੍ਰੋਪਰ ਤਰੀਕੇ ਨਾਲ ਦਿੱਤੀ ਜਾਊਗੀ ਦੋ ਟਾਈਮ ਜਾਂ ਤਿੰਨ ਟਾਈਮ ਠੀਕ ਹੈ ਨਾ ਫੀਡ ਵੀ ਇਸ ਤਰ੍ਹਾਂ ਦੀ ਹੋਊਗੀ ਵੀ ਜਿਹਦੇ ਵਿੱਚ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਲੋੜ ਦੇ ਅਨੁਸਾਰ ਉਹਨਾਂ ਦੇ ਸਰੀਰ ਨੂੰ ਜਿਹੜੇ ਤੱਤ ਚਾਹੀਦੇ ਨੇ ਉਹ ਸਾਰੇ ਪਾਏ ਜਾਣਗੇ ਫੀਡ ਦੇ ਵਿੱਚ ਤਾਂ ਇਸ ਤੋਂ ਬਾਅਦ ਉਹਨਾਂ ਦੀ ਡੇਲੀ ਦੀ ਡੇਲੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਊਗੀ ਤਾਂ ਆਏ ਹਫ਼ਤੇ ਲਾ ਲਓ ਜਾਂ ਪੰਦਰਾਂ ਦਿਨਾਂ ਤੋਂ ਲਾ ਲਓ ਤਾਂ ਆਪਾਂ ਉਸ ਨੂੰ ਜਿਹੜਾ ਕਿ ਇੰਗਜੈਕਸ਼ਨ ਵਗੈਰਾ ਦਿੱਤੇ ਜਾਣਗੇ ਵੀ ਜਿਹਦੇ ਨਾਲ ਉਹਨਾ ਨੂੰ ਕੋਈ ਬਿਮਾਰੀ ਨਾ ਲੱਗੇ ਅਤੇ ਉਹਨਾਂ ਦਾ ਚੈਪ ਕਪ ਪ੍ਰੋਪਰ ਤੌਰ 'ਤੇ ਮਹੀਨੇ ਪੰਦਰਾਂ ਦਿਨਾਂ ਬਾਅਦ ਵੀਹ ਦਿਨਾਂ ਦੇ ਵਿੱਚ ਵਿੱਚ ਹੁੰਦਾ ਰਹੂਗਾ ਅਤੇ ਇਸੇ ਤਰ੍ਹਾਂ ਹੀ ਜਿਹੜੇ ਨੌਜਵਾਨ ਜਿਹੜੇ ਇਹ ਚੂਚੇ ਹੁੰਦੇ ਆ ਜਾਂ ਪਲੋਟਰੀ ਫਾਰਮ ਵਾਲੇ ਕੁੱਕੜ ਹੁੰਦੇ ਨੇ ਉਹਨਾਂ ਦੀ ਦੇਖਭਾਲ ਹੁੰਦੀ ਰਹਿੰਦੀ ਹੈ ਤਾਂ ਜਿਸ ਦੇ ਨਾਲ ਕਿ ਉਹ ਉਹਨਾਂ ਦੀ ਕੁਆਲਿਟੀ ਵਧੀਆ ਤਿਆਰ ਹੁੰਦੀ ਹੈ ਤਾਂ ਕੁਵਾਲਿਟੀ ਤਿਆਰ ਹੋਣ ਤੋਂ ਬਾਅਦ ਜਿਹੜਾ ਉਹਨਾਂ ਦਾ ਵਜਨ ਆ ਉਹ ਵੀ ਚੰਗਾ ਬਣਦਾ ਗਾ ਅਤੇ ਛੇਤੀ ਤਿਆਰ ਹੁੰਦੇ ਆ ਚੂਚੇ ਅਤੇ ਮਰਨ ਦਾ ਜਾਂ ਕੋਈ ਖ਼ਤਰਾ ਨਹੀਂ ਹੁੰਦਾ ਹੈਗਾ ਬਿਮਾਰੀ ਤੋਂ ਰਹਿਤ ਰਹਿੰਦੇ ਨੇ ਤਾਂ ਜਿਹੜਾ ਉਹਨਾਂ ਦਾ ਮੀਟ ਹੈਗਾ ਉਹ ਵੀ ਚੰਗੀ ਕੁਵਾਲਿਟੀ ਦੇ ਵਿੱਚ ਅੱਗੇ ਵਿਕਦਾ ਗਾ